ਹਾਂਜੀ ਮੇਰੇ ਖੇਤਰ ਦੇ ਨੇੜੇ ਬਹੁਤ ਖੇਤਰ ਹਨ ਜੋ ਕਿ ਬਹੁਤ ਸੋਹਣੇ ਹਨ ਅਤੇ ਹਾਂਜੀ ਅਕਸਰ ਘੁੰਮਣ ਜਾਂਦੇ ਹਨ ਚੰਡੀਗੜ੍ਹ ਅਤੇ ਹਿਮਾਚਲ ਵਿੱਚ ਪਹਾੜ ਅਤੇ ਝੀਲਾਂ ਹਨ ਚੰਡੀਗੜ੍ਹ ਸੁਖਨਾ ਝੀਲ ਲਈ ਬਹੁਤ ਪ੍ਰਸਿੱਧ ਹੈ ਜਿੱਥੇ ਲੋਕ ਦੂਰੋਂ ਘੁੰਮਣ ਆਉਂਦੇ ਹਨ ਅਤੇ ਕਿਹਾ ਜਾਂਦਾ ਹੈ ਕਿ ਇਸ ਦੇ ਨਾਲ ਪੁਰਾਣੇ ਸਮਿਆਂ ਵਿੱਚ ਜੰਗਲ ਸਨ ਅਤੇ ਹਾਥੀ ਵੀ ਘੁੰਮਦੇ ਕਰਦੇ ਸਨ ਇਸ ਤੋਂ ਬਿਨਾਂ ਹਿਮਾਚਲ ਵਿੱਚ ਝਰਨੇ ਅਤੇ ਪਹਾੜ ਹਨ ਜਿੱਥੇ ਸਰਦੀਆਂ ਵਿੱਚ ਬਰਫ ਵੀ ਪੈਂਦੀ ਹੈ ਮੌਸਮ ਬਹੁਤ ਸੋਹਣਾ ਹੁੰਦਾ ਹੈ ਲੋਕ ਦੂਰੋਂ ਦੂਰੋਂ ਉਸਨੂੰ ਦੇਖਣ ਆਉਂਦੇ ਹਨ ਇਸ ਨਾਲ ਬਹੁਤ ਵਧੀਆ ਲੱਗਦਾ ਹੈ